ਹਾਂਜੀ ਮੇਰੇ ਅਕੋਰਡਿੰਗ ਭਵਿੱਖ ਵਿੱਚ ਐਰੋਬੀਕ ਭੰਗੜਾ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੋਵੇਗਾ ਕਿਉਂਕਿ ਪਹਿਲਾਂ ਜਿਹੜੇ ਲੋਕ ਸੀ ਉਹ ਯੋਗਾ ਵਗੈਰਾ ਤੋਂ ਕਾਫ਼ੀ ਬੋਰ ਹੋ ਜਾਂਦੇ ਸਨ ਪਰ ਅੱਜ ਦੇ ਟਾਈਮ ਦੇ ਵਿੱਚ ਹੁਣ ਜਿਹੜਾ ਆਰੋਬਿਕ ਭੰਗੜੇ ਦੇ ਨਾਲ ਯੋਗਾ ਕਰਵਾਇਆ ਜਾਂਦਾ ਹੈ ਉਹਦੇ ਵਿੱਚ ਲੋਕਾਂ ਨੂੰ ਕਾਫ਼ੀ ਮਨੋਰੰਜਕ ਹੁੰਦਾ ਹੈ ਅਤੇ ਲੋਕਾਂ ਦਾ ਵਧੀਆ ਟਾਈਮ ਨਿਕਲਦਾ ਹੈ ਅਤੇ ਲੋਗੀ ਲੋਕ ਸਾਰੇ ਦਿਲਚਸਪੀ ਦੇ ਨਾਲ ਯੋਗਾ ਵਿੱਚ ਯੋਗਾ ਕਰਨ ਵਿੱਚ ਆਪਣੀ ਅਨੁਰੁਚੀ ਦਿਖਾਉਂਦੇ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਇਸ ਦੇ ਨਾਲ ਫ਼ਾਇਦਾ ਹੁੰਦਾ ਹੈ ਮੈਂ ਵੀ ਇਹ ਵਾਲਾ ਅਰੋਬਿਕ ਭੰ ਭੰਗੜੇ ਵਾਲਾ ਯੋਗਾ ਪ੍ਰੈਫਰ ਕਰਦੀ ਹਾਂ ਅਤੇ ਇਸ ਦੇ ਨਾਲ ਪੇਟ ਅਤੇ ਹੋਰ ਵੀ ਬਹੁਤ ਸਾਰੇ ਮਸਲਸ ਦੇ ਵਿੱਚ ਬਹੁਤ ਅੱਛਾ ਰਿਜ਼ਲਟ ਮਿਲਦਾ ਹੈ ਇਹਨਾਂ ਨਾਲ ਅਤੇ ਇਸ ਲਈ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਆਰੋਬਿਕ ਭੰਗੜਾ ਇਹ ਕਾਫ਼ੀ ਪ੍ਰਸਿੱਧ ਹੋਵੇਗਾ ਅਤੇ ਬਹੁਤ ਸਾਰੇ ਲੋਕ ਇਸ ਨੂੰ ਅਪਣਾ ਅਪਣਾਉਣਗੇ